ਸਤਿ ਸ਼੍ਰੀ ਅਕਾਲ ਭਾਅ ਜੀ ਭਾਅ ਜੀ ਢਿੱਲੋ ਬ ਟਰੈਵਲ ਤੋਂ ਗੱਲ ਕਰ ਰਹੇ ਜੀ ਭਾਅ ਜੀ ਮੈਨੂੰ ਥੋੜ੍ਹੇ ਟੈਮ ਪਹਿਲਾਂ ਕੋਈ ਕੰਮ ਪੈ ਗਿਆ ਅਚਨਚੇਤ ਕੰਮ ਪੈ ਗਿਆ ਉਹਦੇ ਕਰਕੇ ਮੈਨੂੰ ਜਿਹੜੀ ਕੈਬ ਹੈ ਬੁੱਕ ਕੀਤੀ ਹੋਈ ਉਹ ਕੈਂਸਲ ਕਰਨੀ ਪੈ ਗਈ ਜੀ ਹਾਂਜੀ ਮੈਂ ਨਾ ਡਰੈਵਰ ਨੂੰ ਜੀ ਥੋੜ੍ਹੇ ਪੈਸੇ ਵੀ ਪੇਅ ਕਰਤੇ ਸੀਗੇ ਅੱਧੇ ਇਸ ਕਰਕੇ ਜੀ ਮੈਨੂੰ ਕੈਬ ਹੈ ਜਿਹੜੀ ਅਚਨਚੇਤ ਕੈਂਸਲ ਕਰਨੀ ਪੈ ਗਈ ਭਾਅ ਜੀ ਤੁਸੀਂ ਕਿਰਪਾ ਕਰਕੇ ਜਿਹੜੇ ਪੈਸੇ ਮੇਰੇ ਵਾਪਸ ਕਰ ਦਿਉ ਡਰੈਵਰ ਸਾਹਿਬ ਨੂੰ ਬੋਲ਼ ਕੇ ਪੈਸੇ ਮੇਰੇ ਵਾਪਸ ਗੋਗਲ ਪੇਅ ਮੈਨੂੰ ਕਰ ਦੇਣ ਮੇਰੇ ਅਕਾਊਂਟ ਵਿੱਚ ਆ ਜਾਣ ਐਨੀ ਕਿਰਪਾ ਕਰ ਦਿਓ ਭਾਅ ਜੀ ਬਹੁਤ ਮਿਹਰਬਾਨੀ ਹੋਵੇਗੀ ਤੁਹਾਡੀ ਬਹੁਤ ਬਹੁਤ ਧੰਨਵਾਦ ਜੀ ਹਾਂਜੀ